ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਪਣੇ ਹੱਥ ਨਾਲ ਬਣਾਈਆਂ ਹਨ ਜਿਸ ਤਰਾਂ ਕਿ ਦਰੀਆਂ ਦਰੀਆਂ ਬੁਣਨ ਲਈ ਸਭ ਤੋਂ ਪਹਿਲਾਂ ਉਸਦਾ ਅੱਡਾ ਲਗਾਉਣਾ ਪੈਂਦਾ ਹੈ ਉਸ ਦੇ ਉੱਪਰ ਲੀਰਾ ਲੈ ਕੇ ਚਾਹੇ ਸੂਤਰ ਲੈ ਕੇ ਉਸਨੂੰ ਕੱਤਿਆ ਜਾ ਉੱਪਰ ਲਾਇਆ ਜਾਂਦਾ ਹੈ ਅੱਡਿਆਂ ਉੱਪਰ ਲਾਇਆ ਜਾਂਦਾ ਹੈ ਫਿਰ ਉਸਨੂੰ ਬੁਣਿਆ ਜਾਂਦਾ ਹੈ ਇਸ ਤਰ੍ਹਾਂ ਕਰਨ ਨਾਲ ਦਰੀ ਬਣਦੀ ਹੈ ਇਸ ਤਰ੍ਹਾਂ ਹੀ ਖੇਸ ਨੂੰ ਬਣਾਇਆ ਜਾਂਦਾ ਹੈ ਮੈਂ ਇਸ ਤੋਂ ਇਲਾਵਾ ਜਿਸ ਤਰ੍ਹਾਂ ਕਿ ਪੀੜ੍ਹੀਆਂ ਮੰਜੀਆਂ ਮੈਂ ਬਹੁਤ ਸਾਰੀਆਂ ਚੀਜ਼ਾਂ ਆਪਣੇ ਹੱਥ ਨਾਲ ਬਣਾਈਆਂ ਹਨ ਜਿਸ ਤਰ੍ਹਾਂ ਕਿ ਪੀੜ੍ਹੀ ਪੀੜ੍ਹੀ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਲੋਹੇ ਚਾਹੇ ਲੱਕੜ ਦੀ ਲੱਕੜ ਦੀ ਇੱਕ ਸਟੈਂਡ ਬਣਾਇਆ ਜਾਂਦਾ ਹੈ ਫਿਰ ਉਸ ਤੋਂ ਬਾਅਦ ਵਾਣ ਲੈ ਕੇ ਕਈ ਵਾਣ ਨਾਲ ਬੁਣ ਲੈਂਦੇ ਨੇ ਕਈ ਜਿੱਦਾਂ ਅੱਜ ਕੱਲ੍ਹ ਜਿਹੜੀਆਂ ਨੁਆਰੀ ਚੀਜ਼ਾਂ ਮੰਜੀਆਂ ਬਣਾਈਆਂ ਜਾਂਦੀਆਂ ਜਿਸ ਨਾਲ ਉਹ ਨਵਾਰ ਨਾਲ ਵੀ ਬੁਣੀਆਂ ਜਾਂਦੀਆਂ ਹਨ ਉਸ ਨੂੰ ਪਹਿਲਾਂ ਉੱਪਰ ਬਣਾ ਕੇ ਫਿਰ ਹੱਥਾਂ ਦੇ ਨਾਲ ਵਿੱਚੋਂ ਦੀ ਲੰਘਾ ਕੇ ਵਿੱਚੋਂ ਦੀ ਲੰਘਾ ਕੇ ਕਲਾਕਾਰੀ ਨਾਲ ਵੀ ਡਿਜ਼ਾਈਨਾਂ ਨਾਲ ਵੀ ਪੀੜ੍ਹੀਆਂ ਬੁਣੀਆਂ ਜਾਂਦੀਆਂ ਹਨ ਇਸ ਤੋਂ ਬਾਅਦ ਮੰਜੀ ਦੀ ਗੱਲ ਕਰੀਏ ਤਾਂ ਮੰਜੀ ਨੂੰ ਵੀ ਇੱਕ ਮੰਜੀ ਨੂੰ ਬਣਾਉਣ ਲਈ ਪਹਿਲਾਂ ਇੱਕ ਚਾਰ ਵਿਕ ਚੁਗਾਠ ਬਣਾਈ ਜਾਂਦੀ ਹੈ ਲੋਹੇ ਦੀ ਚਾਹੇ ਲੱਕੜ ਦੀ ਬਣਾ ਲਉ ਉਸ ਤੋਂ ਬਾਅਦ ਵਾਣ ਲਿਆ ਕੇ ਵਾਣ ਨਾਲ ਹੀ ਉਸ ਨੂੰ ਬੁਣਿਆ ਜਾਂਦਾ ਹੈ ਮੰਜੀ ਉਹਨਾਂ ਲਈ ਦੋ ਬੰਦਿਆਂ ਦੀ ਜ਼ਰੂਰਤ ਹੁੰਦੀ ਹੈ ਇਸ ਤਰਾਂ ਕਿ ਇੱਕ ਦਿਨ ਵਿੱਚ ਵੀ ਮੰਜੀ ਬਣਾ ਸਕਦੇ ਇਸ ਬਣ ਜਾਂਦੀ ਹੈ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਹੱਥ ਨਾਲ ਬਣਾਈਆਂ ਅਤੇ ਮੈਨੂੰ ਬਹੁਤ ਸਾਰਾ ਸ਼ੌਂਕ ਇਹਨਾਂ ਦਾ ਬਣਾਉਣ ਦਾ